ਪਿੱਠ ਦੇ ਦਰਦ ਬਾਰੇ ਪਿੱਠ ਦਾ ਦਰਦ ਉਂ ਹੁੰਦਾ ਹੈ ਤਾਂ ਬਹੁਤ ਤਕਲੀਫ ਹੁੰਦੀ ਹੈ ਪਿੱਠ ਦੇ ਦਰਦ ਲਈ ਆਪਾਂ ਨੂੰ ਕੀ ਕੁਛ ਕਰਨਾ ਚਾਹੀਦਾ ਹੈ ਪਹਿਲਾਂ ਪਿੱਠ ਦੇ ਦਰਦ ਬਾਰੇ ਆਪਾਂ ਮੂਵ ਲਗਾਓ ਗਰਮ ਗਰਮ ਪੱਟੀ ਬੰਨੋ ਨਹੀਂ ਤਾਂ ਫਿਰ ਆਪਾਂ ਪਿੱਠ ਦੇ ਦਰਦ ਉੱਤੇ ਗਰਮ ਤੇਲ ਸਰੋਂ ਦਾ ਤੇਸਰੋਂ ਦੇ ਤੇਲ ਵਿੱਚ ਅਜਵਾਇਣ ਆਪਣੀ ਹਿੰਗ ਹੁੰਗ ਹਿੰਗ ਪਾ ਕੇ ਬਾਕੀ ਅਜਵਾਇਣ ਪਾ ਕੇ ਫਿਰ ਇਹ ਸਾਰਾ ਆਪਣੀ ਪਿੱਠ ਦੇ ਦਰਦ ਤੇ ਲਗਾਓ ਇਸ ਨਾਲ ਆਪਾਂ ਨੂੰ ਬਹੁਤ ਆਰਾਮ ਮਹਿਸੂਸ ਹੁੰਦਾ ਹੈ ਪਿੱਠ ਦੇ ਦਰਦ ਦੇ ਆਪਾਂ ਨੂੰ ਬਹੁਤ ਨੁਕਸੇ ਕਰਨੇ ਚਾਹੀਦੇ ਹਨ ਪਿੱਠ ਦਾ ਦਰਦ ਕਿਸੇ ਵੀ ਟਾਈਮ ਹੋ ਸਕਦਾ ਹੈ ਆਪਾਂ ਨੂੰ ਗਰਮ ਗਰਮ ਤੇਲ ਲਾ ਕਰਕੇ ਉਹ ਜ਼ਰੂਰ ਮਲਣਾ ਚਾਹੀਦਾ ਹੈ ਇੱਕ ਆਪਾਂ ਨੂੰ ਗਰਮ ਬੋਤਲ ਪਾਣੀ ਵਿੱਚ ਪਾਣੀ ਭਰ ਕੇ ਉਹ ਵੀ ਆਪਣੇ ਪਿੱਠ ਦੇ ਦਰਦ 'ਤੇ ਫੇਰਨੀ ਚਾਹੀਦੀ ਹੈ ਇਸ ਕਰਕੇ ਆਪਣੇ ਪਿੱਠ ਦੇ ਦਰਦ ਦਾ ਇਲਾਜ ਹੋ ਸਕੇ ਪਿੱਠ ਦੇ ਦਰਦ ਵਾਸਤੇ ਆਪਾਂ ਨੂੰ ਲੋਂਗ ਇਲਾਇਚੀ ਵਾਲੀ ਚਾਹ ਵੀ ਪੀਣੀ ਚਾਹੀਦੀ ਹੈ ਆਪਾਂ ਨੂੰ ਕਈ ਵਾਰੀ ਠੰਡ ਨਾਲ ਵੀ ਪਿੱਠ ਦਾ ਦਰਦ ਹੋਣ ਲੱਗ ਜਾਂਦਾ ਹੈ ਇਸ ਕਰਕੇ ਆਪਾਂ ਨੂੰ ਪਿੱਠ ਦੇ ਦਰਦ ਦੀ ਦੇਖਭਾਲ ਜ਼ਰੂਰੀ ਹੈ ਕਈ ਵਾਰੀ ਆਪਾਂ ਨੂੰ ਲੌਂਗ ਇਲਾਇਚੀ ਛੁਆਰੇ ਬਦਾਮ ਭਿਓਂ ਕੇ ਖਾਣੇ ਚਾਹੀਦੇ ਹਨ ਇਸ ਕਰਕੇ ਪਿੱਠ ਦਾ ਦਰਦ ਠੀਕ ਹੋ ਜਾਂਦਾ ਹੈ ਮੱਲਮ ਮਲੋ ਦਵਾਈ ਜ਼ਰੂਰ ਲਓ ਪਿੱਠ ਦਰਦ ਦੀ ਇਸ ਕਰਕੇ ਆਪਣੇ ਪਿੱਠ ਦਰਦ ਦਾ ਜ਼ਰੂਰ ਆਰਾਮ ਮਹਿਸੂਸ ਹੁੰਦਾ ਹੈ ਆਪਾਂ ਨੂੰ ਪਿੱਠ ਦਰਦ ਬਾਰੇ ਜਲਦੀ ਤੋਂ ਜਲਦੀ ਇਲਾਜ ਕਰਵਾਉਣਾ ਜ਼ਰੂਰੀ ਹੈ